ਥੈਂਕ ਯੂ ਭਾਅ ਜੀ ਪੇਮੈਂਟ ਲਈ ਤੁਸੀਂ ਪੇਟੀਐਮ ਜਾਂ ਫ਼ੋਨਪੇਅ ਜਾਂ ਯੂ ਪੀ ਆਈ ਆਈ ਡੀ ਕੋਈ ਯੂਸ ਕਰਦੇ ਹਾਂ ਤਾਂ ਪਲੀਜ਼ ਮੈਨੂੰ ਦੇ ਦਿਉ ਹਾਂ ਮੈਂ ਉਹਦੇ ਥਰੂ ਪੇਅ ਕਰ ਦਿੰਦਾ ਤੁਹਾਨੂੰ ਠੀਕ ਹੈ ਜੀ ਥੈਂਕ ਯੂ